ਚਿੱਤਰਕਾਰੀ ਦੀਆਂ ਕਲਾਸਾਂ ਅਤੇ ਵਰਕਸ਼ਾਪ ਮੈਂ ਬਹੁਤ ਵਾਰ ਲਾਈਆਂ ਹਨ ਜਦੋਂ ਅਸੀਂ ਸਕੂਲ 'ਚ ਹੁੰਦੇ ਸਾਂ ਤਾਂ ਉਸ ਟਾਈਮ 'ਤੇ ਸਾਡੇ ਅਧਿਆਪਕ ਜਿਹੜੇ ਹੁੰਦੇ ਸੀ ਉਹ ਸਾਨੂੰ ਖੁੱਲ੍ਹੀ ਹਵਾ ਦੇ ਵਿੱਚ ਗਰਾਊਂਡ ਦੇ ਵਿੱਚ ਬਿਠਾ ਦਿਆ ਕਰਦੇ ਸਨ ਅਤੇ ਉੱਥੇ ਬੈਠ ਕੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ ਜਦੋਂ ਅਸੀਂ ਵੱਖ ਵੱਖ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਬੈਠ ਕੇ ਔਰ ਖੁੱਲ੍ਹੇ ਆਸਮਾਨ ਦੇ ਥੱਲੇ ਜਿਹੜੀ ਸਾਡੀ ਅ ਪ੍ਰਕ੍ਰਿਤੀ ਹੈ ਸਾਡੀ ਉਹਦੀ ਅਸੀਂ ਬਹੁਤ ਡੂੰਘੀ ਸਿੱਖਿਆ ਲੈਂਦੇ ਸੀ ਕਿਉਂਕਿ ਬੜੀ ਬਾਰੀਕੀ ਦੇ ਨਾਲ ਪੇੜ ਨੂੰ ਬੈਠ ਕੇ ਦੇਖਣਾ ਦੇਖ ਕੇ ਫਿਰ ਉਸ ਨੂੰ ਬਣਾਉਣਾ ਇਹ ਬਹੁਤ ਹੀ ਵਧੀਆ ਇੱਕ ਅਨੁਭਵ ਹੁੰਦਾ ਸੀ ਸਾਡਾ ਉਸ ਟਾਈਮ 'ਤੇ